ਗੱਤਕਾ ਬਹੁਤ ਹੀ ਮੁੱਖ ਸਿਧਾਂਤ ਜਾਂ ਕਦਰਾਂ ਕੀਮਤਾਂ ਨੂੰ ਸਿਖਾਉਂਦਾ ਹੈ ਔਰ ਇਹ ਜਿਹੜਾ ਦਸਵੇਂ ਪਾਤਸ਼ਾਹ ਦੀਆਂ ਫੌਜਾਂ ਨੇ ਵੀ ਬਹੁਤ ਵੱਡੇ ਪੱਧਰ 'ਤੇ ਇਸ ਗੱਤਕਾ ਦੇ ਵਿੱਚ ਹਿੱਸਾ ਲਿਆ ਜਿਵੇਂ ਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਤਕਾ 'ਚ ਇੰਨੇ ਟ੍ਰੇਨਡ ਕਰ ਦਿੱਤੇ ਔਰ ਸਰੀਰਕ ਤੌਰ 'ਤੇ ਵੀ ਮਜ਼ਬੂਤ ਔਰ ਮਾਨਸਿਕਤਾ ਵੀ ਤੌਰ 'ਤੇ ਮਜਬੂਤ ਔਰ ਉਹਨਾਂ ਨੇ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਅਠਾਰਾਂ ਸਾਲ ਦੀ ਉਮਰ ਦੇ ਵਿੱਚ ਇੱਕੀ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੁਕਾਬਲਾ ਕੀਤਾ ਔਰ ਉਹਨਾਂ ਨੇ ਜਿਹੜਾ ਐ ਸਵਾ ਲਾਖ ਸੇ ਏਕ ਲੜਾਊਂ ਤਵੇ ਤਾਂ ਗੋਬਿੰਦ ਸਿੰਘ ਨਾਮ ਕਹਾਊਂ ਉਹਨਾਂ ਨੇ ਇਹ ਸਿੱਧ ਕਰਕੇ ਦੱਸ ਦਿੱਤਾ ਕਿ ਇਹਦੇ ਵਿੱਚ ਇੰਨਾ ਬਲ ਹੈ ਔਰ ਇੰਨਾ ਇਹਦੇ ਵਿੱਚ ਮਾਨਸਿਕ ਤੌਰ 'ਤੇ ਤਿਆਰ ਹੈ ਉਹ ਸਰੀਰਕ ਪੱਖੋਂ ਮਜ਼ਬੂਤ ਹੋ ਜਾਂਦਾ ਕਿਉਂਕਿ ਜਦੋਂ ਇਹ ਖੇਡਦੇ ਐਂ ਇਹ ਬੜੇ ਜ਼ੋਰ ਦੇ ਨਾਲ ਖੇਡਿਆ ਜਾਂਦਾ ਜੋਸ਼ ਦੇ ਨਾਲ ਖੇਡਿਆ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਬਹੁਤ ਹੀ ਸਿਧਾਂਤਕ ਅਤੇ ਬਹੁਤ ਵਧੀਆ ਜਿਹੜਾ ਗੁਰੂ ਮਹਾਰਾਜ ਦੇ ਉਪਰਾਲੇ ਕੀਤੇ ਹੋਏ ਔਰ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਸਿੱਖ ਕੌਮ ਜਦੋਂ ਕਿਤੇ ਪ੍ਰੋਗਰਾਮ ਹੁੰਦੇ ਬੜੇ ਸਿਧਾਂਤਾਂ ਦੇ ਨਾਲ ਇਹਨਾਂ ਨੂੰ ਜਿਹੜਾ ਖੇਡਿਆ ਜਾਂਦਾ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਬਹੁਤ ਵੱਡੀ ਲੋੜ ਹੈ ਔਰ ਇਹ ਜਿਹੜਾ ਪੂਰੇ ਦੇਸ਼ ਦੇ ਵਿੱਚ ਇਸਨੂੰ ਲਿਜਾਉਣ ਦੀ ਲੋੜ ਹੈ ਕਿਉਂਕਿ ਇਹ ਗੁਰੂਆਂ ਦੀ ਸੋਚ ਦਾ ਜਿਹੜਾ ਗੱਤਕਾ ਹੈ ਔਰ ਇਸ ਗੱਤਕੇ ਬਾਰੇ ਬਹੁਤ ਹਿੰਮਤ ਔਰ ਸੰਘਰਸ਼ ਦੀ ਲੋੜ ਹੈ ਔਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਗੁਰੂਆਂ ਦਾ ਫੁਰਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ